ਹਾਂਜੀ ਅਸੀਂ ਪੰਜਾਬ ਵਿੱਚ ਸਿੱਖਿਆ ਦੇ ਬੁਨਿਆਦੀ ਢਾਂਚੇ ਅਤੇ ਸਰੋਤਾਂ ਨੂੰ ਬਿਹਤਰ ਬਣਾਉਣ ਵਿੱਚ ਜਨਤਕ ਨਿੱਜੀ ਭੂਮਿਕਾ ਜਿਹੜੀ ਅਦਾ ਕਰ ਸਕਦੇ ਹਾਂ ਸਾਨੂੰ ਆਪਣੀ ਪੜ੍ਹਾਈ ਤੋਂ ਬਾਅਦ ਸਿਰਫ ਪੜ੍ਹਾਈ ਤੱਕ ਹੀ ਸੀਮਿਤ ਨਹੀਂ ਰਹਿਣਾ ਚਾਹੀਦਾ ਸਾਨੂੰ ਇਸ ਤਰ੍ਹਾਂ ਦੀਆਂ ਕੁਛ ਸਕਿੱਲਸ ਜਿਹੜੇ ਕੋਰਸ ਆ ਸ਼ੁਰੂ ਕਰਨੇ ਚਾਹੀਦੇ ਹਨ ਜਿਹਦੇ ਨਾਲ ਕਿ ਬੱਚੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜੇਕਰ ਉਹਨਾਂ ਨੂੰ ਜੋਬ ਨਹੀਂ ਵੀ ਮਿਲਦੀ ਕੋਈ ਨੌਕਰੀ ਨਹੀਂ ਮਿਲਦੀ ਤਾਂ ਉਹ ਆਪਣੀ ਸਕਿੱਲ ਦੇ ਅਕੋਰਡਿੰਗ ਕੋਈ ਨਾ ਕੋਈ ਜਿਹੜਾ ਆਪਣਾ ਬਿਜਨਸ ਸਟਾਰਟ ਕਰ ਸਕਣ ਜੇ ਮੈਂ ਗੱਲ ਕਰਾਂ ਸਕਿੱਲ ਦੀ ਤਾਂ ਜਿੱਦਾਂ ਕਿ ਅਸੀਂ ਟਾਈਪਿੰਗ ਵਾਲੀ ਸਕਿੱਲ ਆ ਜਿਹੜੀ ਬੱਚਿਆਂ ਨੂੰ ਸਿਖਾ ਸਕਦੇ ਹਾਂ ਉਹਦੇ ਨਾਲ ਅਸੀਂ ਕਿਤੇ ਵੀ ਇਹ ਜੋਬ ਕਰਕੇ ਵਧੀਆ ਪੈਸੇ ਆ ਜਿਹੜੇ ਕਮਾ ਸਕਦੇ ਹਾਂ ਜੇ ਮੈਂ ਗੱਲ ਕਰਾਂ ਕੁੜੀਆਂ ਲਈ ਤਾਂ ਕੁੜੀਆਂ ਜਿਵੇਂ ਕਿ ਬੂਟੀਕ ਦਾ ਕਰ ਸਕਦੀਆਂ ਆਪਣੀ ਜਿਹੜੀ ਹੈ ਬੂਟੀਕ ਖੋਲ੍ਹ ਸਕਦੀਆਂ ਵੱਖ ਵੱਖ ਤਰ੍ਹਾਂ ਦੇ ਕੱਪੜੇ ਸਿਉਂ ਸਕਦੀਆਂ ਕਿਉਂਕਿ ਅੱਜ ਦੇ ਟਾਈਮ 'ਚ ਜਿਹੜਾ ਬੂਟੀਕ ਹੈ ਇੱਕ ਚੰਗੇ ਬੂਟੀਕ ਵਾਲਾ ਜੋ ਇਨਸਾਨ ਆ ਉਹ ਬਹੁਤ ਵਧੀਆ ਪੈਸੇ ਜਿਹੜੇ ਕਮਾ ਰਿਹਾ ਗਾ ਜਿੱਦਾਂ ਉਹ ਬਿਊਟੀਸ਼ੀਅਨ ਦਾ ਕਰ ਸਕਦੀਆਂ ਬਿਊਟੀ ਪਾਰਲਰ ਆਪਣੇ ਖੋਲ੍ਹ ਸਕਦੀਆਂ ਹੈ ਨਾ ਜਿਵੇਂ ਕੋਈ ਬੂਟੀਕ 'ਤੇ ਸਿਰਫ ਆਪਣੇ ਸੂਟ ਸਿਉਂਣੇ ਹੀ ਨਹੀਂ ਤੁਸੀਂ ਕਢਾਈ ਕਰ ਸਕਦੇ ਹੋ ਜਿੱਦਾਂ ਫੁਲਕਾਰੀਆਂ ਕੱਢਣੀਆਂ ਸਵੈਟਰਾਂ ਬੁਣਨੀਆਂ ਜੈਕਟਾਂ ਬਣਾਉਣੀਆਂ ਇਹੋ ਜਿਹੀਆਂ ਬਹੁਤ ਸਾਰੀਆਂ ਕਲਾ ਨੇ ਜਿਹੜੀਆਂ ਕਿ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਹਨ ਅਤੇ ਤੁਸੀਂ ਕਦੇ ਵੀ ਨੌਕਰੀ ਨਾ ਹੋਣ ਦੇ ਬਾਵਜੂਦ ਇਹ ਨਹੀਂ ਹੈ ਕਿ ਤੁਸੀਂ ਆਰਾਮ ਨਾਲ ਵਿਹਲੇ ਬੈਠ ਸਕਦੇ ਹੋ ਬਲਕਿ ਇਹ ਹੈ ਕਿ ਤੁਸੀਂ ਇੱਕ ਵਧੀਆ ਆਪਣਾ ਬਿਜਨਸ ਸਟਾਰਟ ਕਰਕੇ ਵਧੀਆ ਪੈਸੇ ਕਮਾ ਸਕਦੇ ਹੋ ਅਤੇ ਆਪਣੇ ਘਰ ਦਾ ਖਰਚਾ ਜਿਹੜਾ ਉਹ ਬਹੁਤ ਵਧੀਆ ਤਰੀਕੇ ਨਾਲ ਕਰ ਸਕਦੇ ਹੋ ਤਾਂ ਤੁਹਾਡੇ ਕੋਲ ਸਕਿੱਲਸ ਹੋਣੀਆਂ ਬਹੁਤ ਜ਼ਰੂਰੀ ਨੇ ਤਾਂ ਟਾਈਪਿੰਗ ਹੈ ਕਿ ਟਾਈਪਿੰਗ ਨਾਲ ਜਿਹੜਾ ਬੱਚ ਜਿਵੇਂ ਕਿ ਮੁੰਡਿਆਂ ਦੀ ਟਾਈਪਿੰਗ ਹੈ ਜਿਹੜੇ ਮੁੰਡੇ ਅਤੇ ਕੁੜੀ ਦੋਨਾਂ ਲਈ ਜ਼ਰੂਰੀ ਹੈ ਅਤੇ ਮੁੰਡੇ ਜਿਹੜੇ ਆ ਕੁੜੀਆਂ ਦੀ ਤਰ੍ਹਾਂ ਉਹ ਵੀ ਆਪਣਾ ਬਿਊਟੀਸ਼ਨ ਦਾ ਕਰ ਸਕਦੇ ਆ ਆਪਣਾ ਜਿੱਦਾਂ ਕਿ ਮਹਿੰਦੀ ਲਾਉਣਾ ਇਹ ਵੀ ਇੱਕ ਸਕਿੱਲ ਹੈ ਅਤੇ ਤੁਸੀਂ ਉਹਨਾਂ ਚੀਜ਼ਾਂ ਤੋਂ ਬਹੁਤ ਵਧੀਆ ਪੈਸੇ ਕਮਾ ਸਕਦੇ ਹੋ